ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਤੁਸੀਂ ਚੰਡੀਗੜ੍ਹ ਨਰਸਰੀ ਤੋਂ ਬੋਲ ਰਹੇ ਓਂ ਹਾਂਜੀ ਮੈਨੂੰ ਨਾ ਆਪਣੇ ਘਰ ਵਾਸਤੇ ਘਰ ਦੀ ਬਾਲਕਨੀ ਵਾਸਤੇ ਫਲਾਵਰ ਬੂਟੇ ਚਾਹੀਦੇ ਸੀਗੇ ਉਹਦੇ ਵਾਸਤੇ ਤੁਸੀਂ ਦੱਸ ਸਕਦੇ ਹੋ ਕਿੱਦਾਂ ਦੇ ਫਲਾਵਰ ਬੂਟੇ ਆ ਤੁਹਾਡੇ ਕੋਲ਼ ਮੈਨੂੰ ਆਪਣੀ ਬਾਲਕਨੀ ਵਾਸਤੇ ਹੀ ਚਾਹੀਦੇ ਆ ਜਿੱਦਾਂ ਦੀ ਪਸੰਦ ਹੁੰਦੇ ਅੱਜ ਕੱਲ੍ਹ ਚੱਲ ਰਹੇ ਐਂ ਗਮਲੇ ਪਲਾਸਟਿਕ ਦੇ ਜਿੱਦਾਂ ਦੇ ਵੀ ਹੈਗੇ ਹੈ ਤੁਸੀਂ ਆ ਕੇ ਇੱਕ ਵਾਰੀ ਮੈਨੂੰ ਮੈਂ ਤੁਹਾਡੇ ਉੱਥੇ ਆ ਕੇ ਵੀਜ਼ਿਟ ਕਰ ਸਕਦੀ ਹਾਂ ਨਾ ਅਤੇ ਦੇਖ ਆ ਸਕਦੀ ਹਾਂ ਉੱਥੇ ਤੁਹਾਡੇ ਘਰ ਨਰਸਰੀ 'ਚ ਤੁਸੀਂ ਕੋਈ ਡਿਸਕਾਊਂਟ ਠੀਕ ਤੁਸੀਂ ਹਾਂਜੀ ਤੁਸੀਂ ਡਿਸਕਾਊਂਟ ਵਗੈਰਾ ਵੀ ਦਿੰਦੇ ਹੋ ਹਾਂਜੀ ਹਾਂ ਠੀਕ ਹੈ ਅਸੀਂ ਤੁਹਾਡੇ ਇੱਥੇ ਆ ਕੇ ਦੇਖਾਂਗੇ ਨਾ ਨਰਸਰੀ ਵਿੱਚ ਕਿੱਦਾਂ ਦੇ ਹੈ ਫਿਰ ਮੈਂ ਤੁਹਾਨੂੰ ਦੱਸ ਦਵਾਂਗੀ ਹਾਂਜੀ ਹਾਂਜੀ ਠੀਕ ਓਕੇ ਹਾਂਜੀ ਹਾਂਜੀ ਹਾਂਜੀ ਧੰਨਵਾਦ ਤੁਹਾਡਾ ਧੰਨਵਾਦ